ਵੈਸੇ ਤਾਂ ਮੈਂ ਆਨਲਾਈਨ ਸ਼ਾਪਿੰਗ ਕਰਦੀ ਰਹਿੰਦੀ ਹਾਂ ਪਹਿਲਾਂ ਤਾਂ ਮੈਂ ਲੋਕਾਂ ਦੇ ਵਿਊ ਵੇਖਾਂਗੀ ਅਤੇ ਫਿਰ ਰ ਰੈ ਰੇਟਿੰਗ ਵੇਖਾਂਗੀ ਫਿਰ ਮੈਂ ਚੀਜ਼ ਦੀ ਅਸਲੀ ਫੋਟੋ ਦੇਖਾਂਗੀ ਜੇ ਵਧੀਆ ਲੱਗੂਗਾ ਤਾਂ ਖਰੀਦਾਂਗੀ ਜੇ ਨਾ ਚੰਗਾ ਲੱਗਿਆ ਤਾਂ ਨਹੀਂ ਖਰੀਦਦੀ